ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਐਸੀ ਯਾਦਗਾਰੀ ਘਟਨਾ ਬਾਰੇ ਵਰਣਨ ਕਰਨ ਜਾ ਰਹੀ ਹਾਂ ਜੋ ਮੈਂ ਪਿਛਲੇ ਇੱਕ ਸਾਲ ਵਿੱਚ ਅਨੁਭਵ ਕੀਤੀ ਮੈਂ ਪਿਛਲੇ ਸਾਲ ਦੀਆਂ ਗਰਮੀਆਂ ਵਿੱਚ ਸ਼ਿਮਲਾ ਗਈ ਸੀ ਮੈਂ ਅਤੇ ਮੇਰੇ ਪਰਿਵਾਰ ਨੇ ਪਲੈਨ ਬਣਾਇਆ ਕਿ ਕਿਉਂ ਨਾ ਕਿਤੇ ਘੁੰਮਣ ਜਾਇਆ ਜਾਵੇ ਅਤੇ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਨੂੰ ਯਾਦਗਾਰ ਬਣਾਇਆ ਜਾਵੇ ਤਾਂ ਅਸੀਂ ਫਿਰ ਸ਼ਿਮਲਾ ਜਾਣ ਬਾਰੇ ਸੋਚਿਆ ਸ਼ਿਮਲਾ ਦੀਆਂ ਸੜਕਾਂ ਬਹੁਤ ਹੀ ਸੋਹਣੀਆਂ ਹਨ ਉੱਥੋਂ ਦੇ ਪਹਾੜ ਬਹੁਤ ਆਕਰਸ਼ਿਤ ਹਨ ਅਤੇ ਸੁੰਦਰ ਵੀ ਹਨ ਮੈਨੂੰ ਇਹ ਸਭ ਉਦੋਂ ਪਤਾ ਲੱਗਾ ਜਦੋਂ ਮੈਂ ਸ਼ਿਮਲਾ ਗਈ ਜਦੋਂ ਮੈਂ ਸ਼ਿਮਲੇ ਦੇ ਰਸਤੇ ਵਿੱਚ ਜਾ ਰਹੀ ਹਾਂ ਤਾਂ ਉੱਥੋਂ ਦੀਆਂ ਸੜਕਾਂ ਪਤਲੀਆਂ ਸੀ ਕਿ ਮੈਨੂੰ ਬੜਾ ਹੀ ਡਰ ਲੱਗ ਰਿਹਾ ਸੀ ਪਰ ਮਜ਼ਾ ਵੀ ਆ ਰਿਹਾ ਸੀ ਕਿਉਂਕਿ ਇਹ ਚੀਜ਼ਾਂ ਮੈਂ ਪਹਿਲੀ ਵਾਰੀ ਨੋਟਿਸ ਕਰ ਰਹੀ ਸਾਂ ਸ਼ਿਮਲਾ ਜਾਣ ਤੋਂ ਬਾਅਦ ਮੈਨੂੰ ਪਤਾ ਲੱਗਾ ਉੱਥੋਂ ਦੇ ਕਲਚਰ ਬਾਰੇ ਉੱਥੇ ਮੈਂ ਹੋਰਸ ਰਾਈਡਿੰਗ ਵੀ ਕੀਤੀ ਉਸ ਤੋਂ ਬਾਅਦ ਅਸੀਂ ਕੁਫਰੀ ਵੀ ਗਏ ਜਦੋਂ ਸਨੋਅਫੋਲ ਹੁੰਦੀ ਸੀ ਤਾਂ ਮੇਰੇ ਮਨ ਨੂੰ ਬੜਾ ਹੀ ਪ੍ਰਭਾਵਿਤ ਕਰਦੀ ਸੀ ਮੈਨੂੰ ਇਹ ਸਾਰੀਆਂ ਚੀਜ਼ਾਂ ਉੱਥੋਂ ਦੀਆਂ ਬਹੁਤ ਹੀ ਵਧੀਆ ਲੱਗੀਆਂ ਉੱਥੋਂ ਦਾ ਖਾਣਾ ਵੀ ਬਹੁਤ ਟੇਸਟੀ ਸੀ ਮੈਨੂੰ ਲੱਗਾ ਨਹੀਂ ਸੀ ਕਿ ਇਹ ਟਰਿੱਪ ਬਹੁਤ ਹੀ ਮੇਰੀ ਵਧੀਆ ਜਾਵੇਗੀ ਮੇਰੀ ਉਮੀਦ ਤੋਂ ਵੀ ਜ਼ਿਆਦਾ ਵਧੀਆ ਗਈ ਸੀ ਇਹ ਟਰਿੱਪ ਮੈਂ ਅਤੇ ਮੇਰੀ ਫੈਮਲੀ ਨੇ ਇੱਥੇ ਬਹੁਤ ਇੰਜੋਏ ਕੀਤਾ ਅਤੇ ਇਹ ਮੇਰੇ ਲਾਈਫ 'ਚ ਇੱਕ ਐਸੀ ਘਟਨਾ ਹੈ ਜੋ ਬਹੁਤ ਹੀ ਯਾਦਗਾਰੀ ਹੈ